ਯਾਦਗਾਰ ਘਟਨਾ ਉਹਦੇ ਵਿੱਚ ਮੈਂ ਆਪਣੇ ਆਪਣੇ ਜੀਵਨ ਦਾ ਐਕਸਪੀਰੀਅਂਸ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹੈ ਜਿਹਦੇ ਵਿੱਚ ਮੈਂ ਜਦੋਂ ਮੈਨੂੰ ਕਾਫੀ ਸਾਲਾਂ ਤੋਂ ਪੱਚੀ ਤੋਂ ਤੀਹ ਸਾਲਾਂ ਤੋਂ ਪਿਛਲੇ ਤੋਂ ਮੈਂ ਲਗਭਗ ਇਟਲੀ ਵਿੱਚ ਰਹਿ ਰਿਹਾ ਸੀਗਾ ਉਹਦੇ ਵਿੱਚ ਇਟਲੀ 'ਚ ਲਗਾਤਾਰ ਪੱਚੀ ਤੋਂ ਤੀਹ ਸਾਲ ਰਹਿਣ ਨਾਲ ਜਿਹੜਾ ਮੈਂ ਹੈਗਾ ਆਪਣੇ ਵਿਰਸੇ ਤੋਂ ਕਾਫੀ ਦੂਰ ਹੋ ਗਿਆ ਸੀਗਾ ਜਿਹਦੇ ਕਰਕੇ ਮੈਨੂੰ ਵੀ ਅਤੇ ਮੇਰੇ ਜਿਹੜੇ ਬੱਚੇ ਸੀਗੇ ਉਹ ਵੀ ਮੈਨੂੰ ਵਿਰਸੇ ਤੋਂ ਦੂਰ ਲੱਗੇ ਕਿਉਂਕਿ ਪੰਜਾਬ ਉਹਨਾਂ ਨੂੰ ਵੀ ਪੰਜਾਬੀ ਵਗੈਰਾ 'ਚ ਅਤੇ ਪੰਜਾਬੀਆਂ 'ਚ ਘੱਟ ਇੰਟਰਸਟ ਸੀਗਾ ਆਪਣੀ ਮਿੱਟੀ ਨਾਲ਼ ਪਿਆਰ ਉਹਨਾਂ ਦਾ ਘੱਟਦਾ ਜਾ ਰਿਹਾ ਸੀਗਾ ਪੰਜਾਬ ਨਾਲ਼ ਅਤੇ ਉਹ ਮੈਂ ਉਹਨਾਂ ਨੂੰ ਮਤਲਬ ਆਪਣੀ ਮਿੱਟੀ ਨਾਲ਼ ਮੁੜ ਤੋਂ ਆਪਣਾ ਪਿਆਰ ਉਜਾਗਰ ਕਰਨ ਲਈ ਅਤੇ ਬੱਚਿਆਂ ਨੂੰ ਵੀ ਉਹਨਾਂ ਨੂੰ ਮਤਲਬ ਪੰਜਾਬ ਵਿੱਚ ਆਪਣੀ ਮਿੱਟੀ ਬਾਰੇ ਅਤੇ ਆਪਣੇ ਪ੍ਰਫੁੱਲਤ ਵਿ ਵਿਰਸੇ ਬਾਰੇ ਅਮੀਰ ਵਿਰਸੇ ਬਾਰੇ ਦੱਸਣ ਲਈ ਮੈਂ ਪੱਕਾ ਹੀ ਮੇਰੇ ਬੱਚੇ ਤਾਂ ਥੋੜ੍ਹੇ ਟਾਈਮ ਬਾਅਦ ਇੱਥੋਂ ਮੁੜ ਗਏ ਹੈ ਅਤੇ ਮੈਂ ਇੱਥੇ ਪੱਕਾ ਹੀ ਮਤਲਬ ਪੰਜਾਬ ਵਿੱਚ ਇੱਥੇ ਸੈਟਲ ਹੋਣ ਦਾ ਮਤਲਬ ਨਿਸ਼ਚਾ ਬਣਾ ਲਿਆ ਹੁਣ ਮੈਂ ਪੱਕਾ ਹੀ ਇੱਥੇ ਰਹਾਂਗਾ ਜੀ